ਮੈਨੂੰ ਸਾਈਕਲਿੰਗ ਕਰਨਾ ਬਹੁਤ ਚੰਗਾ ਲੱਗਦਾ ਹੈ ਮੈਂ ਅਕਸਰ ਸਾਈਕਲ ਉੱਤੇ ਕਈ ਥਾਵਾਂ ਉੱਤੇ ਜਾਣਾ ਪਸੰਦ ਕਰਦੀ ਹਾਂ ਜਿਵੇਂ ਗੁਰਦੁਆਰੇ ਮੰਦਰ ਪਾਰਕ ਅਤੇ ਹੋਰ ਥਾਵਾਂ ਉੱਤੇ ਵੀ ਮੈਨੇ ਕਈ ਥਾਵਾਂ ਉੱਤੇ ਸਾਈਕਲ ਸਾਈਕਲਿੰਗ ਉੱਤੇ ਹੀ ਕਈ ਥਾਵਾਂ ਉੱਤੇ ਗਈ ਹਾਂ ਜਿਵੇਂ ਕਿ ਪਾਰਕ ਮੰਦਰ ਗੁਰਦੁਆਰੇ ਮੈਂ ਆਉਣ ਵਾਲੇ ਸਮੇਂ 'ਚ ਅਨੰਦਪੁਰ ਸਾਹਿਬ ਵਿੱਚ ਸਾਈਕਲ ਉੱਤੇ ਜਾਣਾ ਚਾਹੁੰਦੀ ਹਾਂ ਕਿਉਂਕਿ ਉੱਥੇ ਹੋਲੇ ਮੁਹੱਲੇ ਉੱਤੇ ਬਹੁਤ ਰੌਣਕ ਰਹਿੰਦੀ ਹੈ ਅਤੇ ਕਈ ਸ਼ਰਧਾਲੂ ਵੀ ਉੱਥੇ ਆਉਂਦੇ ਹਨ ਉਹ ਗੁਰਦੁਆਰਾ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਅਤੇ ਉੱਥੇ ਜਾਣਾ ਮੇਰੀ ਦਿਲ ਦੀ ਇੱਛਾ ਹੈ